ਹਾਂਜੀ ਹਾਂਜੀ ਵਧੀਆ ਮੈਮ ਤੁਸੀਂ ਦੱਸੋ ਕਿਵੇਂ ਹੋ ਅੱਛਾ ਅੱਛਾ ਹਾਂਜੀ

ਹਾਂਜੀ ਮੈਮ ਮੈਂ ਵੀ ਹਾਲੇ ਸਟਡੀ ਹੀ ਕਰ ਰਹੀ ਮਤਲਬ ਤੁਸੀਂ ਕਿਆ ਕੀ ਮਤਲਬ ਤੁਸੀਂ ਕਿਆ ਕੀਤਾ ਪਲੱਸ ਟੂ ਕੀਤੀ ਹੈ ਹਾਂਜੀ ਹਾਂਜੀ ਮੈਮ ਜਿੱਦਾਂ ਕਿ ਤੁਸੀਂ ਮਤਲਬ ਪਲੱਸ ਟੂ ਦੇ ਵਿੱਚ ਕਿਹੜਾ ਸਬਜੈਕਟ ਰੱਖਿਆ ਹੋਇਆ ਸੀਗਾ ਹਾਂਜੀ ਮੈਮ ਮੈਮ ਜਿਵੇਂ ਕਿ ਜਿੱਦਾਂ ਕਿ ਤੁਸੀਂ ਜਿੱਦਾਂ ਹੁਣ ਆਈ ਟੀ ਆਈ ਤੁਸੀਂ ਕਹਿ ਰਹੇ ਹੋ ਕੰਪਿਊਟਰ ਵਗੈਰਾ ਰੱਖਿਆ ਵਾ ਹੋਣਾ ਤੁਸੀਂ ਹੈ ਨਾ ਹਾਂਜੀ ਮੈਮ ਫਿਰ ਜੇ ਤੁਸੀਂ ਕੰਪਿਊਟਰ ਰੱਖਿਆ ਹੋਇਆ ਸੀਗਾ ਫਿਰ ਤੁਸੀਂ ਕੰਪੀ ਆਹ ਆਈ ਟੀ ਆਈ ਕਰ ਸਕਦੇ ਆਈ ਟੀ ਆਈ ਕੰਪਿਊਟਰ ਦੀ ਕਰ ਸਕਦੇ ਵੀ ਕਾਫੀ ਉਹ ਹੈ ਇਹਦੇ ਨਾਲ ਮਤਲਬ ਇਹਦੀ ਕਾਫੀ ਵੈਲਉ ਜਦੋਂ ਤੁਸੀਂ ਕੋਈ ਵੀ ਕੰਪਨੀ ਦੇ ਵਿੱਚ ਲੱਗਣਾ ਹੈ ਉਹ ਵੀ ਕਰ ਸਕਦੇ ਜਿੱਦਾਂ ਇਹਦੇ ਨਾਲ ਤੁਸੀਂ ਆਈ ਟੀ ਆਈ ਦੇ ਵਿੱਚ ਕਿਤੇ ਵੀ ਜਾ ਸਕਦੇ ਆਈ ਟੀ ਆਈ 'ਚ ਜਾ ਕੇ ਕਿਤੇ ਵੀ ਜੋਬ ਕਰ ਸਕਦੇ ਮਤਲਬ ਆਈ ਟੀ ਆਈ ਕਰਨ ਤੋਂ ਬਾਅਦ ਕਿਤੇ ਅੱਗੇ ਤੁਹਾਨੂੰ ਕੰਪਨੀ 'ਚ ਜੋਬ ਮਿਲ ਜਾਣੀ ਹੈ ਹਾਂਜੀ ਜੇ ਤੁਸੀਂ ਮਤਲਬ ਜਿੱਦਾਂ ਤੁਸੀਂ ਕੈਮਿਸਟਰੀ ਵਗੈਰਾ ਰੱਖੀ ਹੈ ਮਤਲਬ ਕੈਮਿਸਟਰੀ ਮਤਲਬ ਤੁਹਾਨੂੰ ਇੰਟਰਸਟ ਕੈਮਿਸਟਰੀ 'ਚ ਹੈ ਅਤੇ ਤੁਸੀਂ ਮਤਲਬ ਬੀ ਟੈਕ ਵਗੈਰਾ ਕਰ ਸਕਦੇ ਅਤੇ ਉਹਦਾ ਮਤਲਬ ਟੈਸਟ ਹੁੰਦਾ ਅੱਗੇ ਮਤਲਬ ਉਹ ਯੂਨੀਵਰਸਿਟੀ ਦੇ ਟੈਸਟ ਹੁੰਦੇ ਉਹ ਕਲੀਅਰ ਕਰਕੇ ਤੁਸੀਂ ਵਗੈਰਾ ਪੀ ਐਚ ਡੀ ਵਗੈਰਾ ਕਰ ਸਕਦੇ ਹੋ ਕੈਮਿਸਟਰੀ ਵਗੈਰਾ 'ਚ ਫਿਜਿਕਸ 'ਚ ਜੇ ਤੁਸੀਂ ਸਾਇੰਸ ਵਾਲੀ ਫੀਲਡ 'ਚ ਜਾਣਾ ਚਾਹੁੰਦੇ ਹੋ ਹਾਂਜੀ ਮੈਮ ਮੈਂ ਵੀ ਸਟੱਡੀ ਕਰ ਰਹੀ ਮਤਲਬ ਮੈਂ ਵੀ ਸਟੂਡੈਂਟ ਹੀ ਹਾਂ ਅਜੇ ਹਾਂਜੀ ਮੈਮ ਮੈਮ ਮੈਂ ਕਮਰਸ ਕੀਤੀ ਹੋਈ ਹੈ ਮੈਂ ਕਮਰਸ ਕਰਕੇ ਮਤਲਬ ਪਲੱਸ ਟੂ ਕੋਮਰਸ ਕੀਤੀ ਹੈ ਕਮਰਸ ਦਾ ਹੁਣ ਮੈਂ ਸੀ ਏ ਕਰ ਰਹੀ ਚਾਰਟਿ਼ਡ ਅਕਾਂਊਟੈਂਟ ਹਾਂਜੀ ਫਿਰ ਮਤਲਬ ਹੁਣ ਜਿੱਦਾਂ ਮੈਂ ਸੀ ਏ ਕਰਿਆ ਕਰਦੀ ਅਤੇ ਸੀ ਏ ਦੇ ਬਾਅਦ ਜਿੱਦਾਂ ਮਤਲਬ ਕੰਪਨੀ 'ਚ ਮੈਨੂੰ ਸੀ ਏ ਦੀ ਐਦਾਂ ਜੋਬ ਵਗੈਰਾ ਮਿਲ ਜਾਣੀ ਹੈ ਮਤਲਬ ਟੈਸਟ ਵਗੈਰਾ ਕਲੀਅਰ ਕਰਕੇ ਹਾਂਜੀ ਤੁਸੀਂ ਜਿੱਦਾਂ ਜੇ ਤੁਸੀਂ ਕਮਰਸ ਦੇ ਮਤਲਬ ਤੁਹਾਨੂੰ ਕਮਰਸ ਵਧੀਆ ਲੱਗਦੀ ਜਿੱਦਾਂ ਮੈਨੇਜਮੈਂਟ ਵਗੈਰਾ ਜੋ ਤੁਸੀਂ ਕਰ ਸਕਦੇ ਹੋ ਮੈਨੇਜਮੈਂਟ ਦਾ ਕਰਕੇ ਫਿਰ ਇੱਦਾਂ ਨਾ ਟੈਲੀ ਟੈਲੀ ਵਗੈਰਾ ਹੁੰਦੀ ਹੈ ਹਾਂਜੀ ਫਿਰ ਟੈਲੀ ਕਰਕੇ ਤੁਸੀਂ ਟੈਲੀ ਕਰਨ ਤੋਂ ਬਾਅਦ ਜਿੱਦਾਂ ਵੀ ਤੁਹਾਨੂੰ ਜਿਹਦੇ 'ਚ ਵੀ ਇੰਟਰਸਟ ਹੈਗਾ ਹੈ ਤੁਸੀਂ ਇਹ ਟੈਕਨੀਕਲ ਸਕਿੱਲਸ ਤਾਂ ਇਹੀ ਹੈ ਜੇ ਤੁਹਾਨੂੰ ਮਤਲਬ ਇਹਨਾਂ ਵਿੱਚ ਨਹੀਂ ਹੈ ਟੈਕਨੀਕਲ ਸਕਿੱਲ ਆਹ ਵੀ ਹੈ ਜਿੱਦਾਂ ਕਿ ਤੁਸੀਂ ਅੱਜ ਕੱਲ੍ਹ ਤਾਂ ਉਹਦਾ ਵੀ ਹੈਂਡ ਇਬਰੋਡਰੀ ਦਾ ਵੀ ਬਹੁਤ ਉਹ ਹੈ ਜਿੱਦਾਂ ਕਿ ਸਿਲਾਈ ਵਾਲੇ ਵੀ ਉਸ ਹਾਂ ਜੀ ਆਈ ਟੀ ਆਈ ਕਰਨੀ ਤੁਸੀਂ ਤਾਂ ਤੁਸੀਂ ਸਿਲਾਈ ਵਾਲੀ ਆਈ ਟੀ ਆਈ ਵੀ ਕਰ ਸਕਦੇ ਹੋ ਉਹਦੇ ਵਿੱਚ ਮਸ਼ੀਨਾਂ ਦੇ ਨਾਲ ਨਾ ਕੱਪੜੇ ਦੇ ਉੱਤੇ ਕਾਫੀ ਤਰ੍ਹਾਂ ਦੀ ਕਢਾਈਆਂ ਕਢੁਈਆਂ ਵਗੈਰਾ ਵੀ ਕਰਨੀਆਂ ਦੱਸਦੇ ਆ ਜੇ ਤੁਹਾਨੂੰ ਇਸ ਚੀਜ਼ ਦਾ ਸ਼ੌਕ ਹੈ ਸੂਟਾਂ ਦੇ ਉੱਤੇ ਜਿੱਦਾਂ ਇੱਥੇ ਤਾਂ ਮੈਮ ਆਹੀ ਹੈ ਮਤਲਬ ਜੇ ਤੁਸੀਂ ਕ ਆਪਣੇ ਮਤਲਬ ਸਿਟੀ 'ਚ ਦੇਖ ਲਓ ਆਈ ਟੀ ਆਈ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਿਲਾਈ ਵਾਲੀ ਆਈ ਟੀ ਆਈ ਕਰ ਸਕਦੇ ਹੋ 'ਚ ਵੀ ਕਾਫੀ ਵਧੀਆ ਇੱਥੇ ਮਤਲਬ ਕਾਫੀ ਅਪੋਚੁਨੀਟੀ ਹੈ ਇੱਥੇ ਇੱਥੇ ਨਾ ਜਿੱਦਾਂ ਆਹ ਵਾਲੀ ਸਾਡੀ ਮਤਲਬ ਇੱਥੇ ਜਿਹੜੀ ਲੋਕਲ ਆਈ ਟੀ ਆਈ ਹੈ ਇੱਥੇ ਨਾ ਕਾਫੀ ਮਸ਼ੀਨਾਂ ਵਗੈਰਾ ਮਤਲਬ ਮੇਰੀ ਇੱਕ ਫਰੈਂਡ ਹੈ ਉਹ ਵੀ ਕਰਦੀ ਹੈ ਹਾਂਜੀ ਉਹ ਕਰਦੀ ਹੈ ਕਾਫੀ ਵਧੀਆ ਮਤਲਬ ਉਹ ਹੈ ਇੱਥੇ ਮਸ਼ੀਨਾਂ ਵਗੈਰਾ ਹੈ ਉਹ ਮਸ਼ੀਨਾਂ ਦੇ ਨਾਲ ਨਾ ਇਹ ਉਹ ਕਰਨੀਆਂ ਦੱਸਦੇ ਸਰਕਾਰੀ ਹੈ ਆਈ ਟੀ ਆਈ ਜ਼ਿਆਦਾ ਮਤਲਬ ਫੀਸ ਫੂਸ ਵੀ ਹੈ ਨਹੀਂ ਹੈ ਇਹ ਜਿਹੜੀ ਆਈ ਟੀ ਆਈ ਹੈ ਮਤਲਬ ਸਰਕਾਰੀ ਹੈ ਜ਼ਿਆਦਾ ਫੀਸ ਵੀ ਨਹੀਂ ਹੈਗੀ ਇਹ ਨਾ ਇੱਥੇ ਕਾਫੀ ਮਸ਼ੀਨਾਂ ਵਗੈਰਾ ਹੈ ਉਹ ਨਾ ਕੱਪੜੇ ਦੇ ਉੱਤੇ ਕਢਾਈ ਕਰਨਾ ਦੱਸਦੇ ਹਾਂਜੀ ਵਧੀਆ ਹੈ ਹਾਂਜੀ ਹਾਂਜੀ ਹਾਂਜੀ ਕੋਈ ਨਹੀਂ ਇਟਸ ਓਕੇ ਬਾਏ